ਹਾਂਜੀ ਸਾਡੇ ਜ਼ਿਲ੍ਹੇ ਦੇ ਵਿੱਚ ਲਾਇਬ੍ਰੇਰੀ ਹੈਗੀ ਹੈ ਅਤੇ ਇੱਕ ਸਾਡੇ ਕੌਲਜ ਦੇ ਵਿੱਚ ਵੀ ਹੈ ਕੌਲਜ ਦੇ ਵਿੱਚ ਤਾਂ ਕੌਲਜ ਦੇ ਸਟੂਡੈਂਟਸ ਸਟਾਫ਼ ਦੇ ਲਈ ਹੀ ਉਹ ਸੀਮਿਤ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਲਾਇਬ੍ਰੇਰੀ ਹੈ ਉਸਦੇ ਵਿੱਚ ਹਰ ਪ੍ਰਕਾਰ ਦਾ ਆਮ ਆ ਆਦਮੀ ਆ ਕੇ ਆਪਣਾ ਪਾਸ ਬਣਾ ਕੇ ਕਿਸੇ ਪ੍ਰਕਾਰ ਦੀ ਕਿਤਾਬਾਂ ਹਾਸਿਲ ਕਰ ਸਕਦਾ ਹੈ ਪਰ ਮੈਂ ਲਗਭਗ ਤਾਂ ਜਰਨਲ ਨੋਲੇਜ਼ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੀ ਹਾਂ ਜਿਸਦੇ ਨਾਲ ਕਾਫੀ ਮਤਲਬ ਕਿ ਨੋਲੇਜ਼ ਮਿਲਦੀ ਹੈ ਆਉਣ ਵਾਲੇ ਪੇਪਰਾਂ ਦੇ ਵਿੱਚ ਵੀ ਲਗਭਗ ਜਰਨਲ ਨੋਲੇਜ਼ ਦੇ ਪੇਪਰ ਹੀ ਪਏ ਹੁੰਦੇ ਹਨ ਜਿਸ ਨਾਲ ਸਾਨੂੰ ਅੱਗੇ ਕਿਸੇ ਕੌਚਿੰਗ ਸੈਂਟਰ ਤੋਂ ਕੌਚਿੰਗ ਲੈਣ ਦੀ ਲੋੜ ਨਹੀਂ ਪੈਂਦੀ ਅਤੇ ਸਾਨੂੰ ਮਹਿੰਗੀਆਂ ਮਹਿੰਗੀਆਂ ਬਾਹਰ ਤੋਂ ਕਿਤਾਬਾਂ ਲੈਣ ਦੀ ਲੋੜ ਨਹੀਂ ਪੈਂਦੀ ਜੋ ਕਿ ਸਾਨੂੰ ਲਾਇਬ੍ਰੇਰੀ ਦੇ ਵਿੱਚ ਵੀ ਮਿਲ ਜਾਂਦੀ ਹੈ ਜਿਸ ਨਾਲ ਸਾਡੇ ਪੈਸੇ ਦੀ ਵੀ ਬੱਚਤ ਹੁੰਦੀ ਹੈ ਅਤੇ ਸਾਡੇ ਗਿਆਨ ਦੇ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਅਸੀਂ ਆਪਣੇ ਇਸ ਗਿਆਨ ਨੂੰ ਹੋਰਾਂ ਤੱਕ ਵੀ ਪਹੁੰਚਾ ਸਕਦੇ ਹਾਂ ਹੋਰਾਂ ਨੂੰ ਵੀ ਦੱਸ ਸਕਦੇ ਹਾਂ ਕਿ ਤੁਸੀਂ ਲਾਇਬ੍ਰੇਰੀ ਤੋਂ ਕਿਤਾਬਾਂ ਲਉ ਆਪਣਾ ਲਾਭ ਲਉ ਆਪਣੇ ਗਿਆਨ ਦੇ ਵਿੱਚ ਵਾਧਾ ਕਰੋ